ਹੈਲੋ ਓਲਾ ਤੋਂ ਬੋਲਦੇ ਹੋ ਤੁਹਾਡੀ ਕੰਪਨੀ ਦੀ ਗੱਡੀ ਬੁੱਕ ਕੀਤੀ ਸੀ ਅਸੀਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਗਏ ਸੀ ਉੱਥੇ ਅਸੀਂ ਰਾਕ ਗਾਰਡਨ ਸੁਖਨਾ ਝੀਲ ਅਤੇ ਹੋਰ ਵੀ ਜਗ੍ਹਾ 'ਤੇ ਗਏ ਸੀ ਗਏ ਸੀ ਪਰ ਤੁਹਾਡਾ ਡਰਾਈਵਰ ਬਹੁਤ ਹੀ ਚੰਗੇ ਸੁਭਾਅ ਦਾ ਸੀ ਅਸੀਂ ਜਿਹੜੀ ਵੀ ਜਗ੍ਹਾ ਜਾਣਾ ਸੀ ਸਾਨੂੰ ਪਤਾ ਨਹੀਂ ਸੀ ਉਹ ਆਪ ਹੀ ਖੁਦ ਲੈ ਕੇ ਜਾਂਦੇ ਰਹੇ ਸੀ ਸਾਨੂੰ ਪਤਾ ਨਹੀਂ ਸੀ ਪਰ ਉਹ ਸਾਨੂੰ ਸਹੀ ਜਗ੍ਹਾ 'ਤੇ ਲੈ ਕੇ ਗਿਆ ਟਾਈਮ ਦਾ ਵੀ ਪਾਬੰਧ ਸੀ ਅਤੇ ਡਰਾਈਵਰ ਬਹੁਤ ਹੀ ਮਿੱਠੇ ਸੁਭਾਅ ਦਾ ਸੀ ਮਹ ਥੋੜ੍ਹਾ ਜਿਹਾ ਵੀ ਕਾਹਲਾ ਨਹੀਂ ਪਿਆ ਜਿਸ ਕਰਕੇ ਅਸੀਂ ਵਧੀਆ ਉੱਥੇ ਘੁੰਮ ਸਕੇ ਅਤੇ ਘੁੰਮ ਸਕੇ ਅਤੇ ਮਤਲਬ ਕਿ ਉਹਨੇ ਹੋਰ ਵੀ ਥਾਵਾਂ 'ਤੇ ਹੈਲਪ ਕੀਤੀ ਜਿੱਥੇ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਕਿਹੜੀ ਜਗ੍ਹਾ 'ਤੇ ਜਾਣਾ ਹੈ ਇਸ ਕਰਕੇ ਅਸੀਂ ਅੱਗੇ ਤੋਂ ਤੁਹਾਡੀ ਕੰਪਨੀ ਦੀ ਹੀ ਗੱਡੀ ਬੁੱਕ ਕਰਾਂਗੇ